ਮੈਂ ਮਤਲਬ ਕਿ ਬਾਬਾ ਸਾਹਿਬ ਚੌਂਕ ਤੋਂ ਬੋਲ ਰਹੀ ਹਾਂ ਗਲੀ ਜੀਵਨ ਸਿੰਘ ਕਿ ਮੈਂ ਭਰਾਵਾਂ ਦੇ ਢਾਬੇ ਦੇ ਵਿੱਚ ਮੈਨੂੰ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਪਰੌਂਠਾ ਬਹੁਤ ਜ਼ਿਆਦਾ ਪਸੰਦ ਹੈ ਸਾਡੇ ਘਰ ਵੀ ਬਹੁਤ ਪਸੰਦ ਕਰਦੇ ਨੇ ਅਤੇ ਮੈਂ ਉਹਨਾਂ ਨੂੰ ਐਸ ਡੀ ਓ ਐਸ ਓ ਡੀ ਕੋਡ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਕੈਸ਼ ਔਨ ਡਿਲੀਵਰੀ ਨਹੀਂ ਦਿੱਤੀ ਅਤੇ ਮੈਂ ਚਾਹੁੰਦੀ ਸੀ ਕਿ ਮੈਨੂੰ ਕੈਸ਼ ਔਨ ਡਿਲੀਵਰੀ ਦਿਉ ਅਤੇ ਮੈਨੂੰ ਇੱਥੋਂ ਦਾ ਖਾਣਾ ਬਹੁਤ ਪਸੰਦ ਹੈ ਮੇਰੇ ਘਰ ਗੈਸਟ ਆਏ ਹੋਏ ਨੇ ਉਹਨਾਂ ਨੂੰ ਇਹਦਾ ਖਾਣਾ ਸ਼ਾਹੀ ਪਨੀਰ ਦਾਲ ਮੱਖਣੀ ਮਾਂਹ ਪਰੌਂਠਾ ਬਹੁਤ ਜ਼ਿਆਦਾ ਪਸੰਦ ਹੈ ਬਹੁਤ ਪਸੰਦ ਹੈ ਅਤੇ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਇਹੀ ਭਰਾਵਾਂ ਦੇ ਢਾਬੇ ਤੋਂ ਹੀ ਖਾਣਾ ਮੰਗਾਵਾਂ ਇੱਥੋਂ ਦਾ ਮਤਲਬ ਕਿ ਚਾਈਨੀਜ਼ ਫੂਡ ਵੀ ਬਹੁਤ ਵਧੀਆ ਹੈ ਅਤੇ ਪਰ ਇਹ ਮੈਨੂੰ ਕੈਸ਼ ਔਨ ਡਿਲੀਵਰੀ ਨਹੀਂ ਦੇ ਰਹੇ ਜੇ ਅਗਰ ਇਹਨਾਂ ਨੇ ਨਹੀਂ ਦੇਣੀ ਤਾਂ ਮਤਲਬ ਕਿ ਫਿਰ ਮੈਂ ਕਿਸੇ ਹੋਰ ਹੋਟਲ ਦੇ ਵਿੱਚ ਓਰਡਰ ਕਰਾਂ ਅਤੇ ਜ ਵੈਸੇ ਤਾਂ ਮੇਰੀ ਕੋਸ਼ਿਸ਼ ਹੈਗੀ ਤੁਸੀਂ ਇਸ ਓਰਡਰ ਨੂੰ ਕ ਐਸ ਓ ਡੀ ਕੋਡ ਦਿਉ ਅਤੇ ਕੈਸ਼ ਔਨ ਡਿਲੀਵਰੀ ਕਰਵਾਉ ਅਤੇ ਮੈਂ ਇੱਕ ਆਪਣੇ ਪ੍ਰਾਹੁਣਿਆਂ ਨੂੰ ਇਹ ਖਾਣਾ ਖਵਾ ਸਕਾਂ ਪਲੀਜ਼ ਮੇਰੀ ਰਿਕੁਐਸਟ ਹੈ ਅਗਰ ਨਹੀਂ ਕਰਵਾਉਣਾ ਚਾਹੁੰਦੇ ਤਾਂ ਦੱਸਿਉ ਅਤੇ ਫਿਰ ਮੈਂ ਨਹੀਂ ਤਾਂ ਬਾਹਰ ਕਿਤੇ ਹੋਰ ਫਿਰ ਕਿਤੇ ਓਰਡਰ ਕਰਾਂ ਪਲੀਜ਼ ਮੇਰੀ ਰਿਕੁਐਸਟ ਹੈ ਕਿ ਤੁਸੀਂ ਕਰੋ ਕੈਸ਼ ਔਨ ਡਿਲੀਵਰੀ ਜਲਦੀ ਕਰੋ ਅਤੇ ਨਹੀਂ ਤਾਂ ਆਪਣੇ ਹੋਟਲ ਦਾ ਕੋਈ ਬੰਦਾ ਭੇਜ ਦਿਉ ਮੈਂ ਪੇਮੈਂਟ ਕੈਸ਼ ਕਰ ਦੇਵਾਂਗੀ ਉਹ ਕੋਈ ਪ੍ਰੋਬਲਮ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਪਲੀਜ਼ ਪਰ ਤੁਸੀਂ ਭੇਜ ਦਿਉ ਮੇਰੀ ਇਹੀ ਕੋਸ਼ਿਸ਼ ਹੈ ਕਿ ਮੈਂ ਖਾਣਾ ਤੁਹਾਡੇ ਹੀ ਹੋਟਲ ਦਾ ਮੰਗਵਾਵਾਂ ਸਾਨੂੰ ਬਹੁਤ ਪਸੰਦ ਹੈ